ਹੈਲੋ ਹਾਂਜੀ ਕਿਵੇਂ ਹੋ ਵਧੀਆ ਮੈਂ ਨਵੀਂ ਐਡਮਿਸ਼ਨ ਕਰਾਈ ਸੀ ਐੱਸ ਡੀ ਕਾਲਜ ਦੇ ਵਿੱਚ ਮੈਂ ਉੱਥੇ ਮਤਲਬ ਰਹਿਣ ਆਉਣਾ ਸੀ ਪੜ੍ਹਾਈ ਦੇ ਰਿਗਾਰਡਿੰਗ ਵੀ ਮੈਂ ਦੂਸਰੇ ਸ਼ਹਿਰ ਵਿੱਚ ਰਹਿੰਦਾ ਗਾ ਅਤੇ ਮੈਂ ਉੱਥੇ ਹੋਸਟਲ ਦੇ ਵਿੱਚ ਰੂਮ ਲਿਆ ਸੀਗਾ ਮੈਂ ਉੱਥੇ ਮੌਸਮ ਬਾਰੇ ਪੁੱਛਣਾ ਸੀ ਵੀ ਕਿਹੋ ਜਿਹਾ ਗਾ ਵੀ ਮੈਂ ਉਸ ਹਿਸਾਬ ਦੇ ਕੱਪੜੇ ਵਗੈਰਾ ਜਾਂ ਪਲੈਨਿੰਗ ਕਰਕੇ ਆਵਾਂ ਹਾਂਜੀ ਮਤਲਬ ਜ਼ਿਆਦਾ ਠੰਡ ਵਗੈਰਾ ਤਾਂ ਨਹੀਂ ਹੈਗੀ ਜਾਂ ਜ਼ਿਆਦਾ ਗਰਮੀ ਅਤੇ ਮੀਂਹ ਕਰਕੇ ਮਤਲਬ ਕੋਈ ਪ੍ਰੋਬਲਮ ਵਗੈਰਾ ਤਾਂ ਨਹੀਂ ਆ ਰਹੀ ਵੀ ਆਉਣ ਜਾਣ ਦੇ ਵਿੱਚ ਜਾਂ ਕੋਈ ਹੋਰ ਪ੍ਰੋਬਲਮ ਹੋਵੇ ਅੱਛਾ ਅੱਛਾ ਠੀਕ ਆ ਥੈਂਕ ਯੂ ਜੀ ਨਹੀਂ ਬੱਸ ਇੰਨਾਂ ਕੁ ਹੀ ਪੁੱਛਣਾ ਸੀਗਾ ਥੈਂਕ ਯੂ